ਭੰਗੜਾ ਨਾ ਸਿਰਫ ਪੰਜਾਬ ਦੀ ਸੰਸਕ੍ਰਿਤੀ ਦਾ ਇੱਕ ਅਹਿਮ ਹਿੱਸਾ ਹੈ ਬਲਕਿ ਇਹ ਅੱਜ ਕੱਲ੍ਹ ਪੂਰੀ ਦੁਨੀਆਂ ਵਿੱਚ ਇੱਕ ਮਸ਼ਹੂਰ ਐਕਸਰਸਾਈਜ ਅਤੇ ਮਨੋਰੰਜਨ ਦਾ ਸਾਧਨ ਵੀ ਬਣ ਗਿਆ ਹੈ ਇਸ ਨੂੰ ਕਰਨ ਨਾਲ ਸਰੀਰਕ ਤੰਦਰੁਸਤੀ ਅਤੇ ਜ਼ਬਰਦਸਤ ਪ੍ਰਭਾਵ ਪੈਂਦਾ ਹੈ ਕਿਉਂਕਿ ਇਹ ਉੱਚ ਉਤਸ਼ਾਹ ਵਾਲੀ ਕਾਰਡੀਓ ਐਕਸਰਸਾਈਜ ਹੈ ਜੋ ਦਿਲ ਦਿਮਾਗ ਨੂੰ ਤੰਦਰੁਸਤ ਰੱਖਦੀ ਹੈ ਭੰਗੜੇ ਵਿੱਚ ਤੇਜ਼ ਹਿਲ ਚਲ ਛਾਲਾ ਅਤੇ ਹੱਥ ਪੈਰ ਦੀ ਗਤੀ ਸ਼ਾਮਿਲ ਹੁੰਦੀ ਹੈ ਜਿਸ ਨਾਲ ਪੂਰੇ ਸਰੀਰ ਦੀ ਵਰਕ ਆਊਟ ਹੁੰਦੀ ਹੈ ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਬਲੱਡ ਸਰਕੂਲੇਸ਼ਨ ਨੂੰ ਸੁਧਾਰਦਾ ਹੈ ਅਤੇ ਕੈਲੋਰੀ ਕੈਲੋਰੀਜ ਸਾੜਨ ਵਿੱਚ ਮਦਦ ਕਰਦਾ ਇਸ ਤੋਂ ਇਲਾਵਾ ਭੰਗੜਾ ਮਨੋਵਿਗਿਆਨਿਕ ਤੌਰ 'ਤੇ ਵੀ ਬਹੁਤ ਲਾਭਕਾਰੀ ਹੈ ਜਦੋਂ ਕੋਈ ਵਿਅਕਤੀ ਭੰਗੜਾ ਕਰਨ ਕਰਦਾ ਹੈ ਤਾਂ ਉਹ ਆਪਣੇ ਤਨਾਅ ਅਤੇ ਚਿੰਤਾ ਨੂੰ ਭੁੱਲ ਜਾਂਦਾ ਹੈ ਕਿਉਂਕਿ ਇਹ ਮਨ ਨੂੰ ਖੁਸ਼ ਰੱਖਣ ਵਾਲੀ ਗਤੀਵਿਧੀ ਹੈ ਭੰਗੜਾ ਕਰਨ ਨਾਲ ਦਿਮਾਗ ਵਿੱਚ ਐਂਡਰੋਫਿਨ ਖੁਸ਼ਹਾਲੀ ਦੇ ਹਰਮੋਨ ਨਿਕਲਦੇ ਹਨ ਜੋ ਕਿ ਡਿਪਰੈਸ਼ਨ ਅਤੇ ਨਕਾਰਾਤਮਕ ਸੋਚ ਤੋਂ ਛੁਟਕਾਰਾ ਦਿਲਾਉਂਦੇ ਹਨ ਇਸੇ ਲਈ ਬਹੁਤ ਸਾਰੇ ਮਨੋਵਿਗਿਆਨਿਕ ਅਧਿਐਨ ਵਿੱਚ ਇਹ ਦੱਸਦੇ ਹਨ ਕਿ ਨੱਚਣਾ ਗਾਉਣਾ ਅਤੇ ਖਾਸ ਕਰਕੇ ਭੰਗੜਾ ਆਤਮ ਵਿਸ਼ਵਾਸ ਵਧਾਉਣ ਦਾ ਹੈ ਸਮਾਜਿਕ ਜੋੜ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਇੱਕ ਵਿਅਕਤੀ ਨੂੰ ਹੋਰ ਵੀ ਖੁਸ਼ ਮਿਜਾਜ਼ ਅਤੇ ਉਤਸ਼ਾਹੀ ਬਣਾਉਂਦਾ ਹੈ ਇੱਕ ਹੋਰ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਭੰਗੜਾ ਸਾਡੇ ਸਮੂਹਿਕ ਜੀਵਨ ਵਿੱਚ ਇੱਕ ਵੱਡੀ ਭੂਮਿਕਾ ਅਦਾ ਕਰਦਾ ਹੈ ਇਹ ਜਨਮਦਿਨ ਵਿਆਹ ਤਿਉਹਾਰ ਅਤੇ ਖੇਤੀਬਾੜੀ ਨਾਲ ਜੁੜੀਆਂ ਖੁਸ਼ੀਆਂ ਨੂੰ ਮਨਾਉਣ ਦਾ ਇੱਕ ਰਵਾਇਤੀ ਤਰੀਕਾ ਹੈ ਪੰਜਾਬੀ ਸੱਭਿਆਚਾਰ ਵਿੱਚ ਖਾਸ ਕਰਕੇ ਵੇਖੇ ਭੰਗੜਾ ਕਿਸੇ ਵੀ ਸਮਾਗਮ ਦਾ ਅਹਿਮ ਹਿੱਸਾ ਹੁੰਦਾ ਹੈ ਜਿੱਥੇ ਲੋਕ ਇਕੱਠੇ ਹੋ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ ਅੱਜ ਦੇ ਯੁੱਗ ਵਿੱਚ ਜਿੱਥੇ ਲੋਕ ਦਫਤਰਾਂ ਵਿੱਚ ਬੈਠ ਬੈਠਣ ਵਾਲੀ ਜ਼ਿੰਦਗੀ ਜ਼ਿਆਦਾ ਜੀਅ ਰਹੇ ਹਨ ਉਹ ਲਈ ਭੰਗੜਾ ਇੱਕ ਸ਼ਾਨਦਾਰ ਅਤੇ ਮਨੋਰੰਜਕ ਤਰੀਕਾ ਹੈ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਬਣਾਈ ਰੱਖਣ ਰੱਖਣ ਦਾ ਬਹੁਤ ਸਾਰੇ ਫਿਟਨੈਸ ਸੈਂਟਰ ਅਤੇ ਜਿਮ ਵੀ ਹੁਣ ਭੰਗੜਾ ਅਰੋਬਿਕ ਜਾਂ ਭੰਗੜਾ ਵਰਕ ਆਊਟ ਦੇ ਕਾਲਜ ਲਗਾ ਰਹੇ ਹਨ ਜਿਹਨਾਂ ਵਿੱਚ ਲੋਕ ਦਿਲਚਸਪੀ ਲੈ ਰਹੇ ਹਨ ਇਹ ਨਾ ਸਿਰਫ ਸਰੀਰ ਦੀ ਫਿਟਨੈਸ ਲਈ ਵਧੀਆ ਹੈ ਬਲਕਿ ਇਹ ਸਾਨੂੰ ਆਪਣੇ ਪੰਜਾਬੀ ਵਿਰਸੇ ਨਾਲ ਵੀ ਜੋੜ ਕੇ ਰੱਖਦਾ ਹੈ